ਸਤਿ ਸ਼੍ਰੀ ਅਕਾਲ ਜੀ ਮੈਨੂੰ ਬਚਪਨ ਤੋਂ ਹੀ ਚਿੱਤਰਕਾਰੀ ਦਾ ਬਹੁਤ ਸ਼ੌਕ ਸੀ ਮੇਰੇ ਮੰਮੀ ਡੈਡੀ ਨੇ ਮੈਨੂੰ ਬਚਪਨ ਤੋਂ ਹੀ ਰੰਗ ਦਿਲਵਾਣਾ ਸਟਾਰਟ ਕਰ ਦਿੱਤੇ ਸਨ ਬਹੁਤ ਸੋਹਣੇ ਸੋਹਣੇ ਸ ਸਨ ਇੱਕ ਵਾਰੀ ਜਦੋਂ ਮੈਂ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ ਸਾਡੇ ਸਕੂਲ ਵਿੱਚ ਵਰਕਸੋਪ ਲੱਗੀ ਸੀ ਚਿੱਤਰਕਾਰੀ ਦੀ ਹਾਂਜੀ ਸਾਡੇ ਸਕ ਸਕੂਲ ਵਿੱਚ ਇੱਕ ਸਰ ਆਏ ਸੀ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਸਮਝਾਇਆ ਸੀ ਅਤੇ ਮੈਨੂੰ ਸਿੱਖਣ ਲਈ ਬਹੁਤ ਕੁਛ ਮਿਲਿਆ ਸੀ ਉੱਥੇ ਇੱਕ ਮੁਕਾਬਲਾ ਹੋਇਆ ਸੀ ਮੈਂ ਉਸ ਵਿੱਚ ਭਾਗ ਲਿਆ ਸੀ ਮੈਂ ਇੱਕ ਉਹਨਾਂ ਨੇ ਕਿਹਾ ਸੀ ਜੋ ਜੋ ਮਨ ਕਰਦਾ ਤੁਸੀਂ ਬਣਾ ਸਕਦੇ ਹੋ ਮੈਂ ਇੱਕ ਕਮਲ ਦਾ ਫੁੱਲ ਬਣਾਇਆ ਸੀ ਮੈਂ ਗ ਹਮੇਸ਼ਾ ਗੁਲਾਬੀ ਰੰਗ ਹੀ ਭਰਦੀ ਸੀ ਉਹਦੇ ਪੱਤੇ ਵਿੱਚ ਹਰਾ ਰੰਗ ਭਰਦੀ ਸੀ ਅਤੇ ਨੀਚੇ ਪਾਣੀ ਬਣਾ ਦਿੰਦੀ ਸੀ ਜਿਹਦੇ ਵਿੱਚ ਫਰੋਜ਼ੀ ਰੰਗ ਭਰ ਦਿੰਦੀ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਆਪਾਂ ਦੋ ਰੰਗ ਨੂੰ ਮਿਲਾ ਕੇ ਇੱਕ ਤੀਸਰਾ ਰੰਗ ਵੀ ਬਣਾ ਸਕਦੇ ਹਾਂ ਓ ਜਦੋਂ ਮੈਂ ਉਸ ਤ ਮੁਤਾਬਿਕ ਕੰਮ ਕੀਤਾ ਅਤੇ ਮੈਂ ਹੋਰ ਰੰਗ ਦੋ ਦੋ ਰੰਗ ਬਣਾ ਕੇ ਬਹੁਤ ਸੋਹਣਾ ਉਹਨੂੰ ਸਜਾ ਦਿੱਤਾ ਅਤੇ ਫਿਰ ਜਦੋਂ ਮੈਂ ਉਹਨਾਂ ਨੂੰ ਦਿੱਤਾ ਅਤੇ ਮੈਨੂੰ ਫਸਟ ਪ੍ਰਾਈਜ ਦਿੱਤਾ ਉਹਨਾਂ ਨੇ ਅਤੇ ਉਹ ਬਹੁਤ ਖੁਸ਼ ਹੋਏ ਅਤੇ ਮੈਨੂੰ ਮੈਂ ਬਹੁਤ ਕੁਝ ਸਿੱਖ ਲਿਆ ਉਹਨਾਂ ਤੋਂ ਅਤੇ ਮੈਨੂੰ ਚਿੱਤਰਕਾਰੀ ਦਾ ਹੋਰ ਸ਼ੌਕ ਚੜ੍ਹਨ ਲੱਗ ਪਿਆ ਧੰਨਵਾਦ ਜੀ